ਅੱਜ ਦੇ ਸਮੇਂ ਦੇ ਵਿੱਚ ਬਿਜਲੀ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਅੱਜ ਕੱਲ੍ਹ ਹੱਥੀਂ ਕੰਮ ਘੱਟ ਗਿਆ ਹੈ ਅਤੇ ਆਨਲਾਈਨ ਕੰਮ ਬਹੁਤ ਜ਼ਿਆਦਾ ਚੱਲ ਗਿਆ ਹੈ ਸਾਡਾ ਆਪਣਾ ਇੱਕ ਆਨਲਾਈਨ ਬਿਜਨਸ ਹੈ ਜਿਸ ਵਿੱਚ ਅਸੀਂ ਬੱਚਿਆਂ ਦੇ ਫੋਰਮ ਭ ਫਿਲ ਕਰਦੇ ਹਾਂ ਅਗਰ ਬਿਜਲੀ ਸਾਡੇ ਘਰਾਂ ਵਿੱਚ ਨਹੀਂ ਆਉਂਦੀ ਤਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਜਿਸ ਵਿੱਚ ਸਾਡਾ ਆਨਲਾਈਨ ਕੰਮ ਹੈ ਜੋ ਰੁਕ ਜਾਂਦਾ ਹੈ ਜਿਸ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਅਤੇ ਜਿਸ ਵਿੱਚ ਉਹਨਾਂ ਦਾ ਇੰਤਜ਼ਾਰ ਕਰਦੇ ਹਨ ਤਾਂ ਸਾਡੇ ਕਸਟਮਰ ਜੋ ਸਾਡੇ ਲਈ ਕਸਟਮਰ ਗਾਹਕ ਹੁੰਦੇ ਹਨ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਗਾਹਕ ਵੇਟ ਕਰਨੀ ਪੈਂਦੀ ਹੈ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਸਾਡੇ ਜਿਹੜਾ ਰੋਜ਼ੀ ਰੋਟੀ ਹੈ ਜੋ ਸਾਡੀ ਕਮਾਈ ਵਿੱਚ ਘਾਟਾ ਘੱਟ ਹੋ ਜਾਂਦੀ ਹੈ ਕਿਉਂਕਿ ਕਸਟਮਰ ਜ਼ਿਆਦਾਤਰ ਚਲੇ ਜਾਂਦੇ ਹਨ ਕਿਉਂਕਿ ਇਸ ਵਿੱਚ ਸਾਨੂੰ ਬਿਜਲੀ ਆਨਲਾਈਨ ਚਾਹੀਦੀ ਹੈ ਤੇ ਇਸ ਵਿੱਚ ਜੇ ਲਾਈਟ ਨਹੀਂ ਆਉਂਦੀ ਕੱਟ ਲੱਗ ਜਾਂਦੇ ਤਾਂ ਸਾਡੇ ਕੋਲ ਇਨਵੈਟਰ ਵਗੈਰਾ ਦੀ ਸਹੂਲਤ ਨਹੀਂ ਹੁੰਦੀ ਤਾਂ ਸਾਡਾ ਕੰਮ ਹੈ ਜੋ ਰੁਕ ਜਾਂਦਾ ਹੈ ਬਿਜਲੀ ਦੇ ਕੱਟ ਦੌਰਾਨ ਅਸੀਂ ਘਰਾਂ ਵਿੱਚ ਮੋਮਬੱਤੀਆਂ ਲਾਲਟਨ ਸੋਲਰ ਪਾਵਰ ਵਰਤ ਸਕਦੇ ਹਾਂ ਪਰ ਉਸ ਵ ਉਸ ਨੂੰ ਚਲਾਉਣ ਲਈ ਵੀ ਬਹੁਤ ਜ਼ਿਆਦਾ ਚੀਜ਼ਾਂ ਦਾ ਇਸਤੇਮਾਲ ਕਰਨੇ ਪੈਂਦੇ ਹਨ ਕਈ ਵਾਰ ਉਸ ਉਹ ਚੀਜ਼ਾਂ ਸਾਡੇ ਘਰ ਵਿੱਚ ਹੁੰਦੀਆਂ ਅਤੇ ਕਈ ਵਾਰ ਨਹੀਂ ਹੁੰਦੀਆਂ ਹਨ ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਦਿਨ ਸਾਡਾ ਸਾਰਾ ਹੀ ਵੀ ਅਸਾਨੀ ਨਾਲ ਨਹੀਂ ਗੁਜ਼ਰਦਾ ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਇਸ ਲਈ ਬਿਜਲੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਬਿਜਲੀ ਦੇ ਕੱਟ ਦੇ ਦੌਰਾਨ ਅਸੀਂ ਹੋਰ ਨ ਵਰਤੋਂ ਜੋ ਅਸੀਂ ਘਰਾਂ ਵਿੱਚ ਯੂਸ ਕਰਦੇ ਹਾਂ ਮੋਮਬੱਤੀ ਲਾਲਟਨ ਸੋਲਰ ਪਾਵਰ ਅੱਜ ਕੱਲ੍ਹ ਯੂਸ ਕਰਦੇ ਹਨ ਜਿਸ ਵਿੱਚ ਸਾਨੂੰ ਕੰਮ ਕਰਨ ਵਿੱਚ ਥੋੜ੍ਹੀ ਮੋਟੀ ਸਹਾਇਤਾ ਮਿਲ ਜਾਂਦੀ ਹੈ ਅਸੀਂ ਕੁਝ ਟਾਈਮ ਬਿਜਲੀ ਤੋਂ ਦੂਰ ਰਹਿ ਸਕਦੇ ਹਾਂ ਇਸ ਲਈ ਅਸੀਂ ਆਪਣਾ ਸਮਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਬਿਤਾ ਸਕਦੇ ਹਾਂ ਮੋਮਬੱਤੀ ਪੱਖੀ ਸੋਲਰ ਪਾਵਰ ਆਦਿ ਇਕ ਇੱਕ ਇੱਥੇ ਇਨਵੈਟਰ ਬਹੁਤ ਘੱਟ ਲੋਕਾਂ ਕੋਲ ਹੁੰਦੇ ਹਨ ਕਿਉਂਕਿ ਉਹਨਾਂ ਕੋਲ ਇਹ ਚੀਜ਼ ਖਰੀਦਣ ਦੇ ਲਈ ਪੈਸੇ ਕਈ ਲੋਕਾਂ ਕੋਲ ਹੁੰਦੇ ਹਨ ਅਤੇ ਕਈ ਲੋਕ ਨਹੀਂ ਲੈ ਸਕਦੇ ਕਈ ਲੋਕਾਂ ਕੋਲ ਲੈਣ ਲਈ ਹੁੰਦੀਆਂ ਤਾਂ ਉਹਨਾਂ ਘਰ ਘਰ ਕੰਮ ਵਰਕ ਅਤੇ ਸਾਰੇ ਪਾਸੇ ਹੁੰਦਾ ਹੈ ਤਾਂ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਉਹ ਬਿਲਕੁਲ ਅਫੋਰਡ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਕਿ ਉਹਨਾਂ ਨੂੰ ਗਰਮੀ ਦੇ ਵਿੱਚ ਗਰਮੀ ਵੀ ਝੱਲਣੀ ਪੈਂਦੀ ਹੈ ਅਤੇ ਇਸ ਕਰਕੇ ਸ ਕਈ ਲੋਕਾਂ ਦਾ ਜੋ ਕਿ ਹੈ ਆਨਲਾਈਨ ਕੰਮ ਹੁੰਦਾ ਤਾਂ ਉਹ ਵੀ ਰੁਕ ਜਾਂਦਾ ਹੈ ਜਿਵੇਂ ਕਿ ਕਈ ਲੋਕ ਤਨਖਾਨ ਦਾ ਕੰਮ ਕਰਦੇ ਹਨ ਲੱਕੜਾਂ ਵਗੈਰਾ ਦਾ ਉਸ ਵਿੱਚ ਉਹਨਾਂ ਨੂੰ ਜਿਵੇਂ ਆਰੇ ਵਗੈਰਾ ਚਲਾਉਣੇ ਹੁੰਦੇ ਤਾਂ ਉਹ ਬਿਜਲੀ ਨਾਲ ਚੱਲਦੇ ਆ ਅਗਰ ਬਿਜਲੀ ਲਾਇ ਚਲੀ ਜਾਂਦੀ ਹੈ ਤਾਂ ਉਹ ਚੀਜ਼ਾਂ ਇਨਵਰਟਰ 'ਤੇ ਨਹੀਂ ਚੱਲ ਸਕਦੀ ਇਸ ਲਈ ਉਹਨਾਂ ਨੂੰ ਜਨਰੇਟਰ ਦੀ ਜ਼ਰੂਰਤ ਹੁੰਦੀ ਹੈ ਪਰ ਜਨੇਰਟਰ ਚਲਾਉਣ ਲਈ ਉਹਨਾਂ ਨੂੰ ਇੱਕ ਤੇਲ ਵਗੈਰਾ ਦੀ ਯੂਜ ਲੋੜ ਪੈਂਦੀ ਆ ਤੇਲ ਇਨ੍ਹਾਂ ਵੀ ਅੱਜ ਕੱਲ੍ਹ ਘੱਟ ਰਿਹਾ ਇਸ ਲਈ ਉਹਨਾਂ ਨੂੰ ਤੇਲ ਇਹਨਾਂ ਪ੍ਰੋਵਾਈਡ ਨਹੀਂ ਹੋ ਰਿਹਾ ਇਹਨਾਂ ਨਹੀਂ ਵਰਤੋਂ ਵਿੱਚ ਲਿਆ ਜਾ ਰਿਹਾ ਤਾਂ ਉਸਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਮੁਸ਼ਕਿਲ ਪੈਦਾ ਹੋ ਰਹੀ ਹੈ